ਹਾਂ ਮੇਰੇ ਸਕੂਲ ਵਿੱਚ ਇੱਕ ਲਾਈਬ੍ਰੇਰੀ ਹੈ ਜਿਸਨੂੰ ਮੈਂ ਬੜੀ ਵਾਰੀ ਵੇਖਦੀ ਹਾਂ ਬੜੇ ਖੋਹ ਨਾਲ ਵੇਖਦੀ ਹਾਂ ਕਿ ਕਿਹੜੀਆਂ ਕਿਹੜੀਆਂ ਨਵੀਆਂ ਕਿਤਾਬਾਂ ਆਈਆਂ ਮੇਰੇ ਘਰ ਵਿੱਚ ਇੱਕ ਮੇਰੀ ਨਿੱਜੀ ਲਾਈਬ੍ਰੇਰੀ ਏ ਮੈਨੂੰ ਲੱਗਦਾ ਕਿ ਉਹ ਲਾਇਬ੍ਰੇਰੀ ਮੇਰੀ ਸਭ ਤੋਂ ਵਧੀਆਂ ਦੁਨੀਆਂ ਏ ਕਿਉਂਕਿ ਉਹਦੇ ਵਿੱਚ ਹਰ ਤਰ੍ਹਾਂ ਦੀਆਂ ਕਿਤਾਬਾਂ ਮੈਂ ਰੱਖੀਆਂ ਹੋਈਆਂ ਨੇ ਉਹਦੇ ਵਿੱਚ ਗੁਰੂ ਸਾਹਿਬਾਂ ਦੀਆਂ ਜੀਵਨੀਆਂ ਗੁਰੂ ਸਾਹਿਬ ਦੀਆਂ ਪੁਸਤਕਾਂ ਅਤੇ ਭਾਈ ਸ ਪ ਕਾਨ ਸਿੰਘ ਨਾਭਾ ਭਾਈ ਵੀਰ ਸਿੰਘ ਅਤੇ ਹੋਰ ਬਹੁਤ ਸਾਰੇ ਰਾਈਟਰਾਂ ਦੀਆਂ ਬੁੱਕਸ ਇਸ ਤੋਂ ਇਲਾਵਾ ਮੈਂ ਅੰਗਰੇਜ਼ੀ ਕਿਤਾਬਾਂ ਵੀ ਰੱਖੀਆਂ ਹੋਈਆਂ ਨੇ ਜਿਹਦੇ ਵਿੱਚ ਫਸਟ ਥੀਂਗਸ ਫਸਟ ਲਵ ਟੂ ਲੀਡ ਐਂਡ ਹੋਰ ਪਤਾ ਨਹੀਂ ਕੀ ਕੁਛ ਹੈ ਬਟ ਮੈਂ ਇਹੀ ਕਹਿਣਾ ਚਾਹਵਾਂਗੀ ਕਿ ਜੇ ਮੈਨੂੰ ਇਹ ਮੇਰਾ ਘਰ ਨਹੀਂ ਹੈ ਮੈਂ ਇੱਕ ਫਲੈਟ 'ਚ ਰਹਿੰਦੀ ਹਾਂ ਅਤੇ ਮੇਰੇ ਕੋਲ ਇੰਨੀ ਸਪੇਸ ਨਹੀਂ ਹੈਗੀ ਕਿ ਮੈਂ ਇਹਨੂੰ ਪ੍ਰੋਪਰ ਵੇ ਨਾਲ ਪੂਰੀ ਤਰ੍ਹਾਂ ਸਜਾ ਕੇ ਰੱਖਾਂ ਬਸ ਦੋ ਤਿੰਨ ਅਲਮਾਰੀਆਂ ਬਣਾ ਕੇ ਮੈਂ ਇੱਕ ਆਪਣੀ ਲਾਇਬ੍ਰੇਰੀ ਬਣਾਈ ਹੈ ਪਰ ਜਦੋਂ ਮੇਰਾ ਘਰ ਹੋਏਗਾ ਮੈਂ ਡੈਫੀਨੇਟਲੀ ਇੱਕ ਵੱਡਾ ਕਮਰਾ ਆਪਣੀ ਇੱਕ ਲਾਈਬ੍ਰੇਰੀ ਬਣਾਉਣਾ ਚਾਹਵਾਂਗੀ ਜਿਹਦੇ ਵਿੱਚ ਜਾ ਕੇ ਮੈਂ ਆਪਣੇ ਸੁਪਨਿਆਂ ਦੀ ਜ਼ਿੰਦਗੀ ਜੀਅ ਸਕਾਂ ਅਤੇ ਜੋ ਮੈਂ ਚਾਹਾਂ ਉਹ ਮੈਂ ਕਰ ਸਕਾਂ ਮੈਂ ਆਰਾਮ ਨਾਲ ਉਹਨਾਂ ਕਿਤਾਬਾਂ ਦੇ ਵਿੱਚ ਬਹਿ ਕੇ ਆਪਣੀ ਜ਼ਿੰਦਗੀ ਨੂੰ ਮਾਣ ਸਕਾਂ